ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਨੂੰ ਛੱਡ ਕੇ ਦੂਜੇ ਦੇ ਰੀਤੀ ਰਿਵਾਜ਼ਾਂ ਨੂੰ ਬਹੁਤ ਜਲਦੀ ਪਾਲਣਾ ਕਰਦੀ ਹੈ ਜਿਵੇਂ ਕਿ ਇੱਕ ਪੰਜਾਬੀ ਨੌਜਵਾਨ ਆਪਣੇ ਖੇਡਾਂ ਦੇ ਵਿੱਚ ਕਬੱਡੀ ਰੈਸਲਿੰਗ ਕੁਸ਼ਤੀ ਘੋਲ ਅਤੇ ਆਪਣੇ ਆਪ ਨੂੰ ਕਸਰਤ ਅਤੇ ਖੇਤ ਦੇ ਨਾਲ ਜੋੜ ਕੇ ਮਿੱਟੀ ਦੇ ਮਿੱਟੀ ਹੋਣ ਵਾਲੇ ਨੌਜਵਾਨ ਨੂੰ ਇੱਕ ਸੱਭਿਆਚਾਰਕ ਰੀਤਾਂ ਦੀ ਬਹੁਤ ਹੀ ਪਾਲਣਾ ਕਰਨੀ ਬਣਦੀ ਹੈ ਪਰੰਤੂ ਅੱਜ ਦੇ ਯੁੱਗ ਵਿੱਚ ਮਨੁੱਖੀ ਹੱਥੀਂ ਕੰਮ ਕਰ ਕਰਨਾ ਛੱਡਦਾ ਜਾ ਰਿਹਾ ਹੈ ਅਤੇ ਇੱਕ ਸੱਭਿਆਚਾਰਕ ਢਿੱਲੀ ਪਕੜ ਵੀ ਆਪਣੇ ਆਪ ਨੂੰ ਜਵੇਂ ਕਿਸੇ ਦੂਜੇ ਦੇ ਭਾਵ ਦੂਜੇ ਦੇ ਉੱਤੇ ਸਿੱਟ ਕੇ ਸਾਰਾ ਕੁਛ ਕੰਮ ਆਪਣੇ ਸਰੀਰ ਨੂੰ ਸਦਾ ਹੀ ਵਿਹਲਾ ਰੱਖਦਾ ਹੈ ਅਤੇ ਸੱਭਿਆਚਾਰ ਦੀ ਜੇ ਗੱਲ ਕਰ ਲਈਏ ਆਪਣਾ ਪੇਂਡੂ ਸੱਭਿਆਚਾਰ ਛੱਡ ਕੇ ਦੂਜਾ ਹਿੰਦੀ ਜਾਂ ਵੈਸਟਰਨ ਸੱਭਿਆਚਾਰ ਦੀ ਪਕੜ ਕਰਦਾ ਹੈ ਜੋ ਕਿ ਆਪਣੇ ਪਹਿਰਾਵੇ ਅਤੇ ਆਪਣੀ ਹੋਂਦ ਦੇ ਬਿਲਕੁਲ ਉ ਉਲਟ ਹੈ ਜੇ ਆਪਣਾ ਬੰਦੇ ਨੇ ਆਪਣੀ ਹੋਂਦ ਹੀ ਗਵਾ ਲਈ ਅਤੇ ਉਹਦੇ ਪਿੱਛੇ ਕੱਖ ਨਹੀਂ ਰਹਿੰਦਾ